ਹਾਂਜੀ ਸਰ ਕੀ ਹਾਲ ਹੈ ਕੀ ਕਰਦੇ ਸਰਕਾਰ ਬੱਚੇ ਕੀ ਕਰਦੇ ਅੱਛਾ ਜੀ ਅਤੇ ਉਹ ਤਾਂ ਹੈ ਬਾਹਰ ਹੀ ਜਾਣ ਨੂੰ ਫਿਰਦੇ ਸਰ ਤੁਹਾਡੀ ਗੱਲ ਸਹੀ ਹੈ

ਉਹਦੇ ਕਰਕੇ ਬੇਰੁਜ਼ਗਾਰੀ ਬਹੁਤ

ਹਮ ਹਮ

ਹਮ ਹਮ ਹਮ ਉਹ ਹੈ ਤੁਹਾਡੀ ਗੱਲ ਸਹੀ ਹੈ ਹਮ ਹਮ ਉਹ ਤਾਂ ਹੈ ਸਰ ਸਰ ਸਰਕਾਰ ਸੋਚੇ ਤਾਂ ਸਹੀ ਹਮ ਹੋਰ ਸਰ ਪੰਜਾਬ ਖਾਲੀ ਸਹੀ ਗੱਲ ਹੈ ਜੀ ਅਤੇ ਚਲੋ ਆਨ ਆਨਾ ਮੈਂ ਇ ਇੱਕ ਦੋ ਦਿਨ 'ਚ ਆਉਂਦਾ ਮੈਂ ਤੁਹਾਨੂੰ ਮਿਲ ਕੇ ਜਾਊਂਗਾ ਠੀ ਠੀਕ ਹੈ ਸਰ ਠੀਕ ਹੈ ਸਰ ਠੀਕ ਹੈ ਓਕੇ